ਮੈਂ ਅੰਮ੍ਰਿਤ ਕੌਰ ਮੈਂ ਸ਼ੁਰੂ ਤੋਂ ਹੀ ਸਿੱਖ ਧਰਮ ਨੂੰ ਬਿਲੋਂਗ ਕਰਦੀ ਹਾਂ ਮੇਰੇ ਪੇਰੈਂਟਸ ਨੇ ਹਮੇਸ਼ਾਂ ਹੀ ਸਾਨੂੰ ਸਿੱਖੀ ਬਾਰੇ ਹੀ ਦੱਸਿਆ ਹੈ ਉਹਨਾਂ ਨੇ ਹਮੇਸ਼ਾਂ ਸਾਨੂੰ ਇਹੀ ਦੱਸਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰੂ ਨੇ ਔਰ ਉਹਨਾਂ ਦੇ ਆਦੇਸ਼ਾਂ ਅਨੁਸਾਰ ਹੀ ਅਸੀਂ ਆਪਣਾ ਹਰ ਕੰਮ ਕਰਦੇ ਹਾਂ ਸਾਨੂੰ ਸ਼ੁਰੂ ਤੋਂ ਹੀ ਪੇਰੈਂਟਸ ਨੇ ਦੱਸਿਆ ਕਿ ਸਵੇਰੇ ਉੱਠ ਕੇ ਨਿਤਨੇਮ ਕਰਨਾ ਬਾਣੀ ਪੜ੍ਹਨੀ ਔਰ ਗੁਰੂ ਜੀ ਦੇ ਆਦੇਸ਼ਾਂ 'ਤੇ ਚੱਲਣਾ ਅਸੀਂ ਜੋ ਵੀ ਨਵਾਂ ਕੰਮ ਕਰਨਾ ਹੋਵੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਓਹਨਾ ਜੀ ਉਹਨਾਂ ਦੀ ਇਜਾਜ਼ਤ ਲੈ ਕੇ ਉਹ ਕੰਮ ਸ਼ੁਰੂ ਕੀਤ ਕਰਦੇ ਹਾਂ ਔਰ ਸਾਨੂੰ ਸ਼ੁਰੂ ਤੋਂ ਹੀ ਸਿੱਖੀ ਦੇ ਨਾਲ ਜੋੜਿਆ ਗਿਆ ਹੈ